ਪੰਜਾਬੀ ਗੁਰੂਆਂ ਪੀਰਾਂ ਦੇ ਸਮੇਂ ਤੋਂ ਚੱਲ ਰਹੀ ਆ ਰਹੀ ਵਾਲੀ ਭਾਸ਼ਾ ਹੈ ਪੰਜਾਬੀ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਅਲੱਗ ਅਲੱਗ ਤਰੀਕੇ ਦੀ ਬੋਲੀ ਜਾਂਦੀ ਹੈ ਪਰ ਕੁਝ ਲੋਕ ਜਿਵੇਂ ਕਿ ਯੂ ਪੀ ਬੰਗਾਲ ਦੇ ਦੇਸ਼ ਸਟੇਟਾਂ ਵਿੱਚ ਆਉਂਦੇ ਹਨ ਅਤੇ ਓਹਨਾਂ ਨੂੰ ਪੰਜਾਬੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਜਦੋਂ ਉਹ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਓਹਨਾਂ ਦੀ ਪੰਜਾਬੀ ਅਤੇ ਓਹਨਾਂ ਦੀ ਮਾਤ ਭਾਸ਼ਾ ਜੋ ਓਹਨਾਂ ਦੀ ਹੁੰਦੀ ਹੈ ਜਿਵੇਂ ਬੰਗਾਲ ਵਾਲਿਆਂ ਦੀ ਬੰਗਾਲੀ ਉਹ ਮਿਕਸ ਹੋ ਜਾਂਦੀ ਹੈ ਜਿਸ ਕਾਰਨ ਓਹਨਾਂ ਲੋਕਾਂ ਵਿੱਚ ਸਾਫ ਅੰਤਰ ਦਿਖ ਜਾਂਦਾ ਹੈ ਕਿ ਉਹ ਪੰਜਾਬੀ ਨੂੰ ਨਹੀਂ ਜਾਣਦੇ